ਹਾਂਜੀ ਕੌਣ ਜੀ ਜੀ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਠੀਕ ਹੈ ਜੀ ਕਿਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ

ਜ਼ਰੂਰ ਜੀ ਤੁਸੀਂ ਕਿਸ ਜਗ੍ਹਾ 'ਤੇ ਇਸ ਵੇਲੇ ਠੀਕ ਹੈ ਜੀ ਮੈਂ ਪੰਜ ਮਿੰਟ 'ਚ ਤੁਹਾਨੂੰ ਬਸ ਸਟੈਂਡ ਤੋਂ ਪਿਕ ਕਰ ਲੈਂਦਾ ਸਭ ਤੋਂ ਪਹਿਲਾਂ ਕੀ ਦੇਖਣਾ ਚਾਹੋਗੇ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਜੋ ਗੋਲਡਨ ਟੈਂਪਲ ਹੈ ਦੁਨੀਆਂ ਦੇ ਵਿੱਚ ਸਭ ਤੋਂ ਮਸ਼ਹੂਰ ਗੁਰਦੁਆਰਾ ਹੈ ਇਤਿਹਾਸਿਕ ਗੁਰਦੁਆਰਾ ਉਸ ਦੇ ਉੱਪਰ ਉਹਨਾਂ ਨੇ ਸੇਵਾ ਕਰਵਾਈ ਸੋਨੇ ਦੀ ਜੋ ਸੇਵਾ ਕਰਵਾਈ ਹੈ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਹੋਈ ਹੈ ਉਸ ਦੇ ਨਾਲ ਹੀ ਜਲਿਆਂਵਾਲਾ ਬਾਗ ਹੈ ਜਿਸ ਦੇ ਵਿੱਚ ਉਹ ਉੱਨੀ ਸੌ ਸੰਨਤਾਲੀ ਦੇ ਟਾਈਮ 'ਤੇ ਜੋ ਸਾਕਾ ਹੋਇਆ ਉਹ ਵੀ ਕਾਫ਼ੀ ਮਸ਼ਹੂਰ ਹੈ ਔਰ ਇਸ ਦੇ ਨਾਲ ਹੋਰ ਕਾਫ਼ੀ ਚੀਜ਼ਾਂ ਦੇਖਣ ਵਾਲੀਆਂ ਨੇ ਅਟਾਰੀ ਬੋਡਰ ਵਾਹਗਾ ਬੋਡਰ ਜਿਸ ਨੂੰ ਬੋਲਦੇ ਨੇ ਜੀ ਔਰ ਇਸ ਤੋਂ ਇਲਾਵਾ ਜਲੰਧਰ ਉੱਥੇ ਦੇਵੀ ਤਲਾਬ ਮੰਦਰ ਔਰ ਇੱਥੇ ਖਾਲਸਾ ਕੋਲੇਜ ਹੈ ਅੰਮ੍ਰਿਤਸਰ ਦੇ ਵਿੱਚ ਹੀ ਖਾਲਸਾ ਕੋਲੇਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਬਣੀਆਂ ਹੋਈਆਂ ਨੇ ਜੀ ਜੀ ਜੀ ਆਇਆਂ ਨੂੰ ਜੀ